ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਦੱਸੋ ਮੈਮ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਇੱਕ ਵਾਰ ਆਇਓ ਜੀ ਆਪਣੇ ਵਧੀਆ ਔਰਗੈਨਿਕ ਸਬਜ਼ੀਆਂ ਮਿਲਦੀਆਂ ਬਿਨਾਂ ਰੇਹ ਸਪਰੇਅ ਕੀਤੇ ਜਿਹੜੀਆ ਤਾਜ਼ੀਆਂ ਸਬਜ਼ੀਆਂ ਘਰ ਦੀਆਂ ਸਬਜ਼ੀਆਂ ਮਿਲਦੀਆਂ ਨੇ ਜੀ ਆਪਣੀਆਂ ਅਤੇ ਵਧੀਆ ਤਿਆਰ ਕੀਤੀਆਂ ਜਾਂਦੀਆਂ ਹਾਂਜੀ ਆਪਾਂ ਜੀ ਬਿਨਾਂ ਮਤਲਬ ਕਿ ਸਾਰੀਆਂ ਸਬਜ਼ੀਆਂ ਮਿਲ ਜਾਂਦੀਆਂ ਨੇ ਆਪਣੇ ਤਾਜ਼ੀਆਂ ਸਬਜ਼ੀਆਂ ਜਿਹੜੀ ਵੀ ਸਬਜ਼ੀ ਚਾਹੀਦੀ ਆ ਤੁਹਾਨੂੰ ਫਲੀਆਂ ਸ਼ਿਮਲਾ ਮਿਰਚ ਕੋਈ ਵੀ ਸਬਜ਼ੀ ਚਾਹੀਦੀ ਤੁਹਾਨੂੰ ਜਿੱਦਾਂ ਦੀ ਵੀ ਚਾਹੀਦੀ ਆ ਸਾਰੀਆਂ ਸਬਜ਼ੀਆਂ ਮਿਲ ਜਾਣਗੀਆਂ ਜੀ ਆਪਾਂ ਖੁਦ ਹੱਥੀਂ ਆਪਣੇ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਸਾਰੇ ਮਿਲ ਜਾਣਗੀਆਂ ਸਬਜ਼ੀਆਂ ਹਾਂਜੀ ਸਾਰੀਆਂ ਆਪਣੀਆਂ ਹੱਥੀਂ ਉਗਾਈਆਂ ਜਾਂਦੀਆਂ ਨੇ ਸਬਜ਼ੀਆਂ ਬਿਨਾਂ ਰੇਹ ਸਪਰੇਅ ਵਧੀਆ ਤਾਜ਼ੀਆਂ ਸਬਜ਼ੀਆਂ ਹੁੰਦੀਆਂ ਨੇ ਜੀ ਹਾਂਜੀ ਆਪਣੀ ਸ਼ੋਪ ਜੀ ਕੇ ਸੀ ਰੋਡ 'ਤੇ ਸੱਤ ਨੰਬਰ ਗਲੀ 'ਚ ਰਹਿ ਜਾਂਦੀ ਹੈ ਜੀ ਸਿੱਧਾ ਆ ਕੇ ਜੀ ਆਪਣੀ ਸ਼ੋਪ ਆ ਗਈ ਉੱਥੇ ਸਾਰੀਆਂ ਤਾਜ਼ੀਆਂ ਸਬਜ਼ੀਆਂ ਜੀ ਔਰਗੈਨਿਕ ਸਬਜ਼ੀਆਂ ਮਿਲਦੀਆਂ ਨੇ ਆਪਣੇ ਵਧੀਆ ਤੁਸੀਂ ਇੱਕ ਵਾਰ ਵਿਜਿਟ ਕਰਿਓ ਅਤੇ ਆ ਕੇ ਸਬਜ਼ੀਆਂ ਦੇਖਿਓ ਅਤੇ ਲੈ ਕੇ ਜਾਇਓ

ਤੁਸੀਂ ਕਦੋਂ ਵੀ ਆ ਸਕਦੇ ਹੋ ਸਵੇਰ ਦੇ ਦਸ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਕਦੋਂ ਵੀ ਆ ਸਕਦੇ ਹੋ ਆਪਣੇ ਸਾਰੀਆਂ ਸਬਜ਼ੀਆਂ ਹੁੰਦੀਆਂ ਨੇ ਹਾਂਜੀ ਵਧੀਆ ਤਾਜ਼ੀਆਂ ਸਬਜ਼ੀਆਂ ਘਰ ਦੀਆਂ ਸਬਜ਼ੀਆਂ ਹੁੰਦੀਆਂ ਆਪਣੇ ਹਾਂਜੀ ਕਿ ਇਹ ਕਿਸ ਦਿਨ ਚਾਹੀਦੀਆਂ ਨੇ ਜੀ ਆਪਾਂ ਨੂੰ ਸਬਜ਼ੀਆਂ ਹਾਂਜੀ ਹਾਂਜੀ ਮਿਲ ਜਾਣਗੀਆਂ ਜੀ ਲੈ ਜਿਓ ਆਪਣੇ ਘਰ ਦੀ ਸਬਜ਼ੀ ਹੁੰਦੀ ਆ ਵਧੀਆ ਬਿਨਾਂ ਨਾਲੇ ਰੇਹ ਸਪਰੇਅ ਤੋਂ ਉਗਾਈਆਂ ਜਾਂਦੀਆਂ ਨੇ ਜੀ ਆਪਣੇ ਸਬਜ਼ੀਆਂ ਹਾਂਜੀ ਹਾਂਜੀ ਕਾਲ ਕਰਕੇ ਆ ਜਿਓ ਤੁਸੀਂ ਦੱਸ ਦਿਓ ਜਦੋਂ ਵੀ ਆਉਣਾ ਹੋਇਆ ਹਾਂਜੀ ਤੁਹਾਨੂੰ ਸਾਰੀਆਂ ਸਬਜ਼ੀਆਂ ਹਾਂਜੀ ਮਿਲ ਜਾਣਗੀਆਂ ਹਾਂਜੀ ਹਾਂਜੀ ਗਲੀ ਨੰਬਰ ਸੱਤ 'ਚ ਹਾਂਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ